ਸਰਕਾਰ ਨੂੰ ਇੱਕ ਬਹੁਤ ਜ਼ਰੂਰੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਕਿ ਸਾਨੂੰ ਪਤਾ ਹੈ ਗਰੀਬ ਬੰਦਾ ਆਪਣੀ ਸਿਹਤ ਦਾ ਖਿਆਲ ਰੱਖਣ ਨਹੀਂ ਸਕਦਾ ਕਿਉਂਕਿ ਉਸ ਕੋਲ ਇੰਨੇ ਪੈਸੇ ਨਹੀਂ ਹੁੰਦੇ ਕਿ ਉਹ ਆਪਣੇ ਲਈ ਦਵਾਈ ਲਿਆਵੇ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਕਿ ਉਹ ਸਾਰੇ ਹਰ ਇੱਕ ਪਿੰਡ ਜਾਂ ਸ਼ਹਿਰ ਜਾਂ ਕਸਬਿਆਂ ਵਿੱਚ ਦੋ ਜਾਂ ਇੱਕ ਅਪ ਕਲੀਨਿਕ ਜ਼ਰੂਰ ਖੋਲੇ ਉਸ ਵਿੱਚ ਘੱਟ ਤੋਂ ਘੱਟ ਜਾਂ ਫਰੀ ਹੀ ਦਵਾਈ ਦਿੱਤੀ ਜਾਵੇ ਅਤੇ ਸਰਕਾਰ ਨੂੰ ਸਰਕਾਰੀ ਹੋਸਪੀਟਲ ਵੀ ਬਣਾਉਣੇ ਚਾਹੀਦੇ ਹਨ ਜਿਸ ਵਿੱਚ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾਵੇ ਧੰਨਵਾਦ